ਇੱਕ ਵਾਰ ਇੱਕ ਮੇਰੇ ਇੱਕ ਦੋਸਤ ਦਾ ਸੋਸ਼ਲ ਮੀਡੀਆ ਅਕਾਊਂਟ ਇੰਸਟਾ 'ਤੇ ਹੈਕ ਹੋ ਗਿਆ ਸੀ ਅਤੇ ਉਹ ਉਸਨੂੰ ਕੁਝ ਦਿਨਾਂ ਤੋਂ ਪਤਾ ਹੀ ਨਹੀਂ ਸੀ ਅਚਾਨਕ ਉਸਨੇ ਦੇਖਿਆ ਕਿ ਉਸ ਉਸਦਾ ਸੋਸ਼ਲ ਮੀਡੀਆ ਇੰਸਟਾਗਰਾਮ ਜੋ ਕਿ ਦੂਸਰੇ ਵਿਅਕਤੀ ਦੂਸਰੀ ਲੋਕੇਸ਼ਨ 'ਤੇ ਸ਼ੋ ਹੋ ਰਿਹਾ ਸੀ ਕਿ ਇਹ ਇੱਥੇ ਯੂਜ ਹੋ ਰਿਹਾ ਹੈ ਅਤੇ ਦੂਜਾ ਉਸਦੇ ਜਦੋਂ ਉਹ ਕੋਈ ਵੀ ਮੈਸੇਜ ਕਿਸੇ ਨੂੰ ਨਹੀਂ ਸੀ ਕਰਦਾ ਬਟ ਸੈਕਿੰਡ ਪਰਸਨ ਜਿਸ ਨੇ ਉਸਦੀ ਆਈ ਡੀ ਹੈਕ ਕੀਤੀ ਹੋਈ ਸੀ ਉਹ ਅਨੋਨ ਪਰਸਨਸ ਨੂੰ ਵੀ ਉਸਦੀ ਆਈ ਡੀ ਤੋਂ ਮੈਸੇਜ ਔਰ ਕਾਲਸ ਕਰ ਰਿਹਾ ਸੀ ਜਿਸ ਤੋਂ ਉਸਨੂੰ ਪਤਾ ਲੱਗਿਆ ਕਿ ਉਸਦਾ ਸੋਸ਼ਲ ਮੀਡੀਆ ਅਕਾਊਂਟ ਹੈਕ ਹੋ ਚੁੱਕਿਆ ਹੈ ਇਸ ਲਈ ਉਸਨੇ ਸਭ ਤੋਂ ਪਹਿਲਾਂ ਆਪਣੇ ਸੋਸ਼ਲ ਮੀਡੀਆ ਸ ਦੀ ਸਕਿਉਰਟੀ ਚੈੱਕ ਕੀਤੀ ਅਤੇ ਉਸਦੇ ਕੁਛ ਪਾਸਵਰਡ ਚੇਂਜ ਕੀਤੇ ਔਰ ਆਪਣੀ ਜੋ ਵੀ ਉਸ ਨਾਲ ਅਟੈਚ ਈਮੇਲ ਵਗੈਰਾ ਸੀ ਉਸਨੂੰ ਚੇਂਜ ਕੀਤਾ ਜਿੱਦਾਂ ਕਿ ਉਸਦੀ ਆਈ ਡੀ ਦੁਬਾਰਾ ਹੈਕ ਨਾ ਹੋ ਸਕੇ ਅਤੇ ਉਸਨੇ ਅੱਗੇ ਤੋਂ ਇਸ ਚੀਜ਼ ਦੀ ਵੀ ਜਲੀਤ ਵੀ ਧਿਆਨ ਦਿੱਤਾ ਕਿ ਉਹ ਆਪਣੀ ਸੋਸ਼ਲ ਮੀਡੀਆਜ ਦੇ ਪਾਸਵਰਡ ਨੂੰ ਸਟਰੋਂਗ ਅਤੇ ਵਧੀਆ ਰੱਖੇ ਆਸਾਨ ਨਾ ਰੱਖੇ ਇਹਨਾਂ ਚੀਜ਼ਾਂ ਤੋਂ ਸਭ ਨੂੰ ਹੀ ਇੱਕ ਸਬਕ ਮਿਲਿਆ ਅਤੇ ਸਭ ਹੀ ਬੱਚਿਆਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਪਾਸਵਰਡਸ ਨੂੰ ਸਟਰੋਂਗ ਕੀਤਾ ਅਤੇ ਉਹਨਾਂ ਦੀ ਸਿਕਿਉਰਟੀ ਦੀ ਆਪਸ਼ਨਸ ਜੋ ਉਹ ਪ੍ਰੋਵਾਈਡਰ ਹੁੰਦੀਆਂ ਹਨ ਉਹ ਚੀਜ਼ਾਂ ਦਾ ਚੈੱਕ ਚੈੱਕਆਊਟ ਕੀਤਾ ਅਤੇ ਪਰਮਿਸ਼ਨ ਔਨ ਕੀਤੀਆਂ ਤਾਂ ਜੋ ਉਹਨਾਂ ਦਾ ਕੋਈ ਵੀ ਸੋਸ਼ਲ ਮੀਡੀਆ ਅਕਾਊਂਟ ਹੈਕ ਨਾ ਹੋ ਸਕੇ